ਸਤਿ ਸ਼੍ਰੀ ਅਕਾਲ ਜੀ ਤੁਸੀਂ ਕਰਤਾਰ ਟਰਾਂਸਪੋਰਟ ਏਜੰਸੀ ਤੋਂ ਗੱਲ ਕਰ ਰਹੇ ਹੋਂ ਹਾਂਜੀ ਅਸੀਂ ਦਿੱਲੀ ਜਾਣ ਦੇ ਲਈ ਤੁਹਾਡੀ ਕੈਬ ਬੁੱਕ ਕੀਤੀ ਸੀਗੀ ਅਤੇ ਤੁਸੀਂ ਕਿਹਾ ਸੀਗਾ ਕਿ ਤੁਹਾਡੇ ਘਰ ਕੈਬ ਹੈ ਜਿਹੜੀ ਉਹ ਤਿੰਨ ਵਜੇ ਪਹੁੰਚ ਜਾਊਗੀ ਅਤੇ ਸਾਡੀ ਦਿੱਲੀ ਪਹੁੰਚਣ ਦਾ ਟੀਚਾ ਸੀਗਾ ਕਿ ਅਸੀਂ ਉੱਥੇ ਨੌ ਵੱਜ ਦੇ ਨੂੰ ਪਹੁੰਚ ਜਾਈਏ ਤਾਂ ਕਿ ਸਾਡੀ ਫਲਾਈਟ ਹੈ ਜਿਹੜੀ ਉਹ ਗਿਆਰਾਂ ਵਜੇ ਹੈ ਦੋ ਘੰਟੇ ਪਹਿਲਾਂ ਅਸੀਂ ਉੱਥੇ ਪਹੁੰਚਣਾ ਚਾਹੁੰਦੇ ਸੀਗੇ ਕਿ ਤਾਂ ਕਿ ਅਸੀਂ ਇਜ਼ੀਲੀ ਹੈ ਜਿਹੜਾ ਉੱਥੇ ਚੈੱਕਇਨ ਕਰ ਲਈਏ ਪਰ ਤੁਹਾਡੇ ਡਰਾਈਵਰ ਸਾਹਿਬ ਨੇ ਜਿਹੜੇ ਉਹ ਇੱਕ ਘੰਟਾ ਲੇਟ ਆਏ ਜਿਸ ਕਰਕੇ ਜਿਹੜੀ ਉਹ ਸਾਡੀ ਫਲਾਈਟ ਹੈ ਉਹ ਸਾਡੇ ਤੋਂ ਮਿਸ ਹੋ ਚੁੱਕੀ ਹੈ ਸੋ ਹੁਣ ਅਸੀਂ ਚਾਹੁੰਦੇ ਆ ਕਿ ਜਿਹੜੀ ਅਸੀਂ ਤੁਹਾਨੂੰ ਸੱਤ ਹਜ਼ਾਰ ਰੁਪਇਆ ਪੇਮੈਂਟ ਕੀਤੀ ਸੀਗੀ ਐਡਵਾਂਸ ਦੇ ਵਿੱਚ ਉਹ ਸਾਡੀ ਰਿਫੰਡ ਕੀਤੀ ਜਾਵੇ ਕਿਉਂਕਿ ਸਾਡੀ ਫਲਾਈਟ ਜਿਹੜੀ ਅਸੀਂ ਲੱਖ ਰੁਪਏ ਦੀ ਟਿਕਟ ਬੁੱਕ ਕੀਤੀ ਸੀਗੀ ਉਹ ਸਾਡੀ ਤੁਹਾਡੇ ਡਰਾਈਵਰ ਦੀ ਗਲਤੀ ਦੇ ਕਰਕੇ ਉਹ ਮਿਸ ਹੋ ਗਈ ਪੰਜਾਹ ਪ੍ਰਸੈਂਟ ਰਿਫੰਡ ਨਹੀਂ ਜੀ ਸਾਨੂੰ ਕਿਰਪਾ ਕਰਕੇ ਦ ਪੂਰਾ ਰਿਫੰਡ ਦਿੱਤਾ ਜਾਵੇ ਜਾਂ ਫਿਰ ਜਿਹੜੀ ਅਸੀਂ ਅਗਲੀ ਵਾਰ ਬੁੱਕ ਕੀਤੀ ਹੈ ਫਲਾਈਟ ਉਹਦੇ ਵਾਸਤੇ ਆ ਜਿਹੜਾ ਸਾਨੂੰ ਕੈਬ ਹੈ ਜਿਹੜੀ ਉਹ ਉਪਲੱਬਧ ਕਰਵਾਈ ਜਾਵੇ ਇਹਨਾਂ ਹੀ ਪੇਮੈਂਟ ਦੇ ਪੈਸਿਆਂ ਦੇ ਨਾਲ ਠੀਕ ਹੈ ਜੀ ਹਾਂਜੀ ਅਗਲੀ ਫਲਾਈਟ ਹੈ ਜਿਹੜੀ ਉਹ ਸਾਡੀ ਉਹ ਵੀਹ ਜਨਵਰੀ ਨੂੰ ਹੈ ਤੁਸੀਂ ਕਿਰਪਾ ਕਰਕੇ ਕੈਬ ਹੈ ਜਿਹੜੀ ਉਹ ਵੀਹ ਜਨਵਰੀ ਨੂੰ ਤਿੰਨ ਵਜੇ ਕਿਰਪਾ ਕਰਕੇ ਟਾਈਮ 'ਤੇ ਪਹੁੰਚਾ ਦਿਓ ਠੀਕ ਹੈ ਜੀ ਧੰਨਵਾਦ